ਵੀਹ ਦਿਨ ਪਹਿਲਾਂ ਮੈਂ ਆਪਣੀ ਕਮੀਜ਼ ਮੰਗਵਾਈ ਸੀਗੀ ਸ਼ਰਟ ਅਤੇ ਜਦੋਂ ਉਹਦੀ ਪੈਕਿੰਗ ਦੇਖੀ ਬਹੁਤ ਬੁਰਾ ਹਾਲ ਸੀ ਅਤੇ ਬਾਅਦ 'ਚ ਚਲੋ ਮੈਂ ਉਹਨੂੰ ਖੋਲ੍ਹ ਕੇ ਦੇਖਿਆ ਖੋਲ੍ਹਣ ਤੋਂ ਬਾਅਦ ਜਦ ਮੈਂ ਸ਼ਰਟ ਦੇਖੀ ਸ਼ਰਟ ਮੈਂ ਬਲੈਕ ਕਲਰ ਦੀ ਕਰੀ ਸੀਗੀ ਔਡਰ ਅਤੇ ਉਹ ਵਿੱਚੋਂ ਲਾਲ ਰੰਗ ਦੀ ਨਿਕਲੀ ਅਤੇ ਸ਼ਰਟ ਦਾ ਜਮਾ ਹੀ ਬੁਰਾ ਹਾਲ ਸੀਗਾ ਮੈਂ ਆਪਣਾ ਟੋਮੀ ਦੀ ਸ਼ਰਟ ਮੰਗਵਾਈ ਸੀਗੀ ਜਿਹੜੀ ਕਿ ਜਮਾ ਹੀ ਲੋਕਲ ਕਿਸੇ ਦੇਸੀ ਜਿਹੀ ਕੰਪਨੀ ਦੀ ਨਿਕਲੀ ਅਤੇ ਬਾਕੀ ਇਹਦੇ 'ਚ ਸਾਰੀ ਧਾਗੇ ਨਿਕਲੇ ਹੋਏ ਸੀਗੇ ਅਤੇ ਕਾਲਰ ਵਗੈਰਾ ਵੀ ਬਟਨ ਵਗੈਰਾ ਸਾਰਾ ਕੁਛ ਕੁਛ ਵੀ ਨਹੀਂ ਸੀਗਾ ਅਤੇ ਆਪਣਾ ਇਹਨੂੰ ਮੰਗਵਾ ਕੇ ਮੈਂ ਬਹੁਤ ਦੁਖੀ ਹੋਇਆ ਅਤੇ ਮੇਰੇ ਘਰ ਦੇ ਮੈਨੂੰ ਬਹੁਤ ਬੋਲੇ ਅਤੇ ਆਪਣਾ ਜਿਹੜੀ ਚੀਜ਼ ਮੈਂ ਆਪਣਾ ਮੇਰੇ ਲੋਕਲ ਬਾਜ਼ਾਰ ਤੋਂ ਮੈਂ ਸਸਤੀ ਲੈ ਸਕਦਾ ਸੀ ਉਹ ਔਨਲਾਈਨ ਮੈਂ ਦੋ ਹਜ਼ਾਰ ਦੀ ਬੁੱਕ ਕੀਤੀ ਅਤੇ ਮੇਰਾ ਬਹੁਤ ਜ਼ਿਆਦਾ ਬੈਡ ਐਕਸਪੀਰੀਅੰਸ ਰਿਹਾ ਇਹਦੇ ਨਾਲ ਅਤੇ ਮੈਨੂੰ ਬਿਲਕੁਲ ਸਵਾਦ ਨਹੀਂ ਆਇਆ ਤੁਹਾਡਾ